ਹੈਲੋ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਤੁਸੀਂ ਭਾਰਤ ਗੈਸ ਏਜੰਸੀ ਤੋਂ ਬੋਲਦੇ ਹੋ ਹਾਂਜੀ ਸਰ ਮੇਰਾ ਨਾ ਗੈਸ ਸਿਲੰਡਰ ਖਤਮ ਹੋ ਗਿਆ ਸੀ ਅਤੇ ਮੈਂ ਮਤਲਬ ਪਿਛਲੇ ਕਾਫੀ ਟਾਈਮ ਤੋਂ ਮਤਲਬ ਘੰਟੇ ਤੋਂ ਟਰਾਈ ਕਰ ਰਹੀ ਹਾਂ ਫੋਨ ਮੈਂ ਇੰਨੀ ਵਾਰ ਫੋਨ ਲਗਾਇਆ ਬਟ ਤੁਹਾਡਾ ਫੋ ਨੰਬਰ ਹੈ ਜਦੋਂ ਮਿਲ ਨਹੀਂ ਰਿਹਾ ਸੀਗਾ ਅਤੇ ਬਹੁਤ ਮੁਸ਼ਕਿਲ ਨਾਲ ਤੁਹਾਡਾ ਹੁਣ ਜਾ ਕੇ ਕਿਤੇ ਨੰਬਰ ਮਿਲਿਆ ਅਤੇ ਸਰ ਮੇਰੀ ਤਾਂ ਇਹੀ ਰਿਕੁਐਸਟ ਹੈ ਇੱਕ ਤੁਹਾਨੂੰ ਦੋ ਤੋਂ ਤਿੰਨ ਨੰਬਰ ਜ਼ਰੂਰ ਰੱਖਣੇ ਚਾਹੀਦੇ ਤਾਂ ਕਿ ਜਿੰਨੇ ਵੀ ਮਤਲਬ ਕਸਟਮਰ ਆਏ ਆ ਹੈ ਨਾ ਕੋਈ ਵੀ ਲੋਕ ਹੈ ਨਾ ਤੁਹਾਨੂੰ ਫੋਨ ਕਰਦੇ ਆ ਅਤੇ ਕਿਉਂਕਿ ਉਹ ਪੂਰਾ ਨਿਸ਼ਚਿੰਤ ਹੋ ਕੇ ਫੋਨ ਕਰ ਸਕਣ ਕਿ ਹਾਂ ਮੇਰੀ ਜਿਹੜੀ ਮਤਲਬ ਕਿ ਭਾਰਤੀ ਜੰਸੀ ਹੈ ਨਾ ਵੀ ਬਹੁਤ ਵਧੀਆ ਗੱਲ ਸੁਣਦੇ ਬਹੁਤ ਵਧੀਆ ਮਤਲਬ ਕਿ ਕਸਟਮਰਸ ਨਾਲ ਡੀਲ ਕਰਦੇ ਆ ਬਾਕੀ ਤੁਹਾਡੀ ਜਿਹੜੀ ਭਾਰਤ ਗੈਸ ਏਜੰਸੀ ਆਂ ਨਾ ਇਹ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਵਧੀਆ ਹੈ ਨਾ ਮਤਲਬ ਲੋਕਾਂ ਦੀਆਂ ਸੁਵਿਧਾਵਾਂ ਪ੍ਰੋਵਾਈਡ ਕਰਦੀ ਹੈ ਹੈ ਨਾ ਅਤੇ ਪਰ ਬਸ ਆ ਫੋਨ ਨੰਬਰ ਦਾ ਥੋੜ੍ਹਾ ਹੈ ਨਾ ਧਿਆਨ ਦਿੱਤਾ ਜਾਵੇ